ਹਾਂ ਮੈਨੂੰ ਸ਼ਾਸਤਰੀ ਸੰਗੀਤ ਗਾਉਣਾ ਪਸੰਦ ਹੈ ਕਿਉਂਕਿ ਸ਼ਾਸਤਰੀ ਸੰਗੀਤ ਸਾਡੀ ਸੱਭਿਆਚਾਰ ਨਾਲ ਜੁੜਿਆ ਹੋਇਆ ਇੱਕ ਅੰਗ ਹੈ ਸ਼ਾਸ ਸ਼ਾਸਤਰੀ ਸੰਗੀਤ ਇੱਕ ਅਜਿਹਾ ਮੱਧਿਅਮ ਹੈ ਜਿਸ ਨਾਲ ਸਾਨੂੰ ਸਕੂਨਤਾ ਅਤੇ ਰੂਹਦਾਰੀ ਦਾ ਸਕੂਨ ਪ੍ਰਾਪਤ ਹੁੰਦਾ ਹੈ ਸਮਕਾਲੀ ਸੰਗੀਤ ਅੱਜ ਕੱਲ ਬਹੁਤ ਹੀ ਦੁਨੀਆਂ ਵਿੱਚ ਛਾਇਆ ਹੋਇਆ ਹੈ ਜਿਸ ਕਾਰਨ ਲੋਕ ਵੱਧ ਤੋਂ ਵੱਧ ਸਮਕਾਲੀ ਸੰਗੀਤ ਨਾਲ ਜੁੜ ਰਹੇ ਹਨ ਅਤੇ ਸਾਡੇ ਸਾਸਤਰੀ ਸੰਗੀਤ ਨੂੰ ਭੁੱਲ ਰਹੇ ਹਨ ਸਾਨੂੰ ਲੋੜ ਹੈ ਕਿ ਸਾਨੂੰ ਸ਼ਾਸਤਰੀ ਸੰਗੀਤ ਨੂੰ ਵੀ ਪ੍ਰਸਿੱਧ ਕਰਨਾ ਚਾਹੀਦਾ ਹੈ ਤੇ ਗਾਉਣਾ ਜਰੂਰੀ ਚਾਹੀਦਾ ਹੈ ਜਿਵੇਂ ਕਿ ਲਤਾ ਮੰਗੇਸ਼ਵਰ ਜੀ ਸ਼ਾਸਤਰੀ ਸੰਗੀਤ ਨਾਲ ਬਹੁਤ ਅਹਿਮ ਰੋਲ ਰੱਖਦੇ ਹਨ ਜਿਸ ਨਾਲ ਸਾਨੂੰ ਸ਼ਾਸਤਰੀ ਸੰਗੀਤ ਬਾਰੇ ਪ੍ਰਾਪਤ ਨੌਲੇਜ ਮਿਲਦੀ ਹੈ ਯਾਨੀ ਕਿ ਗਿਆਨ ਸਾਨੂੰ ਯੂਟੀਊਬ ਤੋਂ ਵੀ ਸਿੱਖਿਆ ਜਾ ਸਕਦਾ ਹੈ ਸ਼ਾਸਤਰੀ ਗੀਤ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਅਸੀਂ ਆਪਣੀ ਸਕੂਨਤਾ ਤੇ ਰੂਹਦਾਰੀ ਨੂੰ ਪੇਸ਼ ਕਰ ਸਕਦੇ ਹਾਂ ਸ਼ਾਸਤਰੀ ਸੰਗੀਤ ਨਾਲ ਹੀ ਸਾਨੂੰ ਰਿਆਜ਼ ਅਤੇ ਵੱਧ ਤੋਂ ਵੱਧ ਕਰਨ ਦੀ ਲੋੜ ਹੁੰਦੀ ਹੈ ਰਿਆਜ਼ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਅਸੀਂ ਆਪਣੀ ਆਵਾਜ਼ ਨੂੰ ਬਖੂਬੀ ਢੰਗ ਨਾਲ ਪੇਸ਼ ਕਰ ਸਕਦੇ ਹਾਂ ਜਾਨੀ ਕਿ ਸਮਕਾਲੀ ਟਾਈਮ ਸਮਕਾਲੀ ਸਮੇਂ ਤੋਂ ਹੀ ਸੰਗੀਤ ਬਹੁਤ ਪ੍ਰਸਿੱਧ ਆ ਰਿਹਾ ਹੈ ਅਤੇ ਕਲਾਸਿਕਲ ਨੂੰ ਲੋਕ ਭੁੱਲ ਰਹੇ ਹਨ ਸੰਗੀਤ ਇੱਕ ਅਜਿਹਾ ਜਰੀਆ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਸਗੋਂ ਸੰਗੀਤ ਨਾਲ ਜੁੜਿਆ ਜਾ ਸਕਦਾ ਹੈ ਇਹ ਸਾਡੇ ਜ਼ਿੰਦਗੀ ਦਾ ਇੱਕ ਅਹਿਮ ਰੁ ਰੋਲ ਅਦਾ ਕਰਦਾ ਹੈ ਸ਼ਾਸਤਰੀ ਸੰਗੀਤ ਹਾਲਾਂਕਿ ਮੁਸ਼ਕਿਲ ਹੈ ਪਰ ਜਿਆਦਾ ਇਕੱਠੀ ਨਹੀਂ ਹੈ ਸਾਨੂੰ ਵੱਧ ਤੋਂ ਵੱਧ ਰਿਆਜ਼ ਦੀ ਲੋੜ ਲੋੜ ਚਾਹੀਦੀ ਹੈ ਅਤੇ ਸਾਨੂੰ ਇੱਕ ਤਰ੍ਹਾਂ ਦਾ ਇਕਾਗਰਤਾ ਮਨ ਚਿੱਤ ਲਾ ਕੇ ਸਮ ਸਮਕਾਲੀ ਸੰਗੀਤ ਨਾਲ ਜੁੜਨਾ ਪਸੰਦ ਕਰਨਾ ਚਾਹੀਦਾ ਹੈ ਸਮਕਾਲੀ ਸੰਗੀਤ ਹੀ ਮੈਨੂੰ ਜਿਆਦਾ ਵਧੀਆ ਲੱਗਦਾ ਹੈ ਜਦ ਕਿ